ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਔਨਲਾਈਨ ਦਾ ਜ਼ਮਾਨਾ ਹੈਗਾ ਏ ਆ ਅਤੇ ਅਸੀਂ ਕੋਈ ਵੀ ਸਾਡੇ ਕੋਲ ਲੋਕਾਂ ਦੇ ਕੋਲ ਇੰਨਾਂ ਟਾਈਮ ਨਹੀਂ ਹੁੰਦਾ ਹੈਗਾ ਆ ਕਿ ਅਸੀਂ ਦੁਕਾਨ ਤੋਂ ਜਾ ਕੇ ਇੱਕ ਇੱਕ ਚੀਜ਼ ਖਰੀਦੀ ਜਾਵੇ ਕਿਉਂਕਿ ਸਾਨੂੰ ਡੇਲੀ ਦੇ ਸਮਾਨ ਦੇ ਲਈ ਹੀ ਰੋਜ਼ ਹੀ ਦ ਦੁਕਾਨ ਨੂੰ ਜਾਣਾ ਪੈਂਦਾ ਹੈਗਾ ਪਰ ਅੱਜ ਦੇ ਬਿਜ਼ੀ ਜ਼ਮਾਨੇ ਦੇ ਵਿੱਚ ਸਾਨੂੰ ਰੋਜ਼ ਹੀ ਦੁਕਾਨ ਤੋਂ ਜਾਣ ਤੋਂ ਇਲਾਵਾ ਸਾਡੇ ਕੋਲ ਇੱਕ ਹੋਰ ਔਪਸ਼ਨ ਹੈਗੀ ਹੈ ਜਿਹੜੀ ਕਿ ਔਨਲਾਈਨ ਸ਼ੋਂਪਿੰਗ ਦੀ ਹੈਗੀ ਹੈ ਜਿੱਦਾਂ ਕਿ ਹੁਣ ਸਰਦੀਆਂ ਦਾ ਮੌਸਮ ਆ ਰਿਹਾ ਹੈਗਾ ਅਤੇ ਸਾਨੂੰ ਸਾਡੇ ਸੀਨੀਅਰਸ ਜਿਹੜੇ ਟੀਚਰਸ ਹੈਗੇ ਉਹਨਾਂ ਨੇ ਵੀ ਬੋਲ ਦਿੱਤਾ ਹੈਗਾ ਹੈ ਕਿ ਤੁਸੀਂ ਪ੍ਰੋਪਰ ਯੂਨੀਫੋਮ ਦੇ ਵਿੱਚ ਆਉਣਾ ਹੈਗਾ ਯੂਨੀਫੋਮ ਦੇ ਵਿੱਚ ਜਿੱਦਾਂ ਕਿ ਸਾਨੂੰ ਬਲੇਜ਼ਰਸ ਵਗੈਰਾ ਜ਼ਰੂਰੀ ਹਨ ਤੇ ਮੈਂ ਇੱਕ ਬਲੇਜ਼ਰ ਔਨਲਾਈਨ ਦੇਖਿਆ ਸੀਗਾ ਜਿਹੜਾ ਕਿ ਐਮਾਜ਼ੋਨ ਸਾਈਟਸ 'ਤੇ ਦੇਖਿਆ ਸੀਗਾ ਮੈਨੂੰ ਐਮਾਜ਼ੋਨ ਸਾਈਟ ਬਹੁਤ ਵਧੀਆ ਲੱਗਦੀ ਹੈਗੀ ਆ ਕਿਉਂਕਿ ਐਮਾਜ਼ੋਨ ਸਾਈਟਸ ਹ ਇੱਕ ਭਰੋਸੇ ਵਾਲੀ ਸਾਈਟ ਹੈਗੀ ਆ ਜੇ ਅਸੀਂ ਉਹ ਤੋਂ ਕੁਛ ਵੀ ਮੰਗਾਉਂਦੇ ਹੈਗੇ ਆ ਉਹ ਨਾਲ਼ ਸਾਨੂੰ ਗਰੰਟੀ ਵੀ ਦਿੰਦੇ ਹੈਗੇ ਆ ਅਤੇ ਜੇ ਉੱਥੋਂ ਕੋਈ ਵੀ ਸਮਾਨ ਖ਼ਰਾਬ ਆ ਜਾਂਦਾ ਹੈਗਾ ਤਾਂ ਉਹ ਉਹਨੂੰ ਵਾਪਸ ਵੀ ਕਰਦੇ ਹੈਗੇ ਆ ਅਤੇ ਉਹਦੇ ਪੈ ਪੇਮੈਂਟ ਵੀ ਵਾਪਸ ਕਰ ਦਿੰਦੇ ਹੈਗੇ ਆ ਇਸ ਕਰਕੇ ਮੈਂ ਹਮੇਸ਼ਾਂ ਐਮਾਜ਼ੋਨ ਸਾਈਟ ਤੋਂ ਹੀ ਆਪਣਾ ਸਮਾਨ ਮੰਗਾਉਂਦੀ ਹੈਗੀ ਅਤੇ ਮੈਂ ਫਸਟ ਟਾਈਮ ਉੱਥੋਂ ਇੱਕ ਬਲੇਜ਼ਰ ਔਡਰ ਕੀਤਾ ਆ ਜਿਹੜਾ ਕਿ ਮੈਨੂੰ ਬਹੁਤ ਹੀ ਵਧੀਆ ਲੱਗਿਆ ਹੈਗਾ ਉਹਦਾ ਕਲਰ ਐਸਟੀਜੀ ਆਇਆ ਹੈਗਾ ਏ ਜਿੱਦਾਂ ਕਿ ਮੈਂ ਫੋਟੋ ਵਿੱਚ ਦਿਖਾਇਆ ਗਿਆ ਸੀਗਾ ਅਤੇ ਉਹਦਾ ਸਾਈਜ਼ ਵੀ ਬਿਲਕੁਲ ਮੇਰੇ ਪ੍ਰੋਪਰ ਆਇਆ ਹੈਗਾ ਹੈ ਅਤੇ ਮੈਨੂੰ ਉਹ ਪ੍ਰੋਡਕਟ ਬਹੁਤ ਪਸੰਦ ਆਇਆ ਹੈਗਾ ਏ ਆ ਅਤੇ ਮੈਂ ਤੁਹਾਨੂੰ ਵੀ ਇਹੀ ਕਹਿਣਾ ਚਾਹੁੰਦੀ ਹੈਗੀ ਹਾਂ ਕਿ ਜੇ ਤੁਸੀਂ ਕੁਛ ਵੀ ਮੰਗਵਾਉਣਾ ਹੈਗਾ ਅਤੇ ਐਮਾਜ਼ੋਨ ਸਾਈਟ ਤੋਂ ਮੰਗਵਾਇਆ ਕਰੋ ਕਿਉਂਕਿ ਉਹ ਇੱਕ ਭਰੋਸੇ ਵਾਲੀ ਐਪ ਹੈਗੀ ਆ ਅਤੇ ਇੱਕ ਟਰੱਸਟਡ ਐਪ ਹੈਗੀ ਹੈ ਅਤੇ ਹਮੇਸ਼ਾਂ ਉਹ ਸਾਨੂੰ ਜੋ ਇਮੇਜ਼ 'ਤੇ ਦਿਖਾਉਂਦੇ ਹੈਗੇ ਆ ਉਹੀ ਪ੍ਰੋਡਕਟ ਭੇਜਦੇ ਹੈਗੇ ਕਦੇ ਵੀ ਉਹ ਹੇਰਾਫੇਰੀ ਨਹੀਂ ਕਰਦੇ ਹੈਗੇ ਆ ਸਾਡੇ ਦੇ ਨਾਲ਼ ਅਸੀਂ ਜੋ ਮੰਗਵਾਉਂਦੇ ਹੈਗੇ ਸਿਰਫ਼ ਸਾਨੂੰ ਉਹੀ ਭੇਜਦੇ ਆ ਧੰਨਵਾਦ